ਮੈਂ ਨਿਊਜ਼ਪੇਪਰਾਂ ਵਿੱਚ ਇਕੱਲੀਆਂ ਖਬਰਾਂ ਪੜ੍ਹਦਾ ਹਾਂ ਜਿਹਨਾਂ ਵਿੱਚ ਪੋਲੀਟਿਕਸ ਬਾਰੇ ਦਿੱਤਾ ਜਾਂਦਾ ਹੈ ਜਾਂ ਕਿਸ ਕਿਤੇ ਹੋਰ ਜਗ੍ਹਾ 'ਤੇ ਕੋਈ ਲੜਾਈ ਹੋਵੇ ਝਗੜਾ ਹੋ ਗਿਆ ਉਹਨਾਂ ਬਾਰੇ ਦ ਦੱਸਿਆ ਜਾਂਦਾ ਹੈ ਅਤੇ ਕੋਈ ਆਪਣਾ ਐਡਵਰਟਾਈਜਮੈਂਟ ਆ ਗਈ ਉਹਦੇ ਵਿੱਚ ਦੱਸਿਆ ਜਾਂਦਾ ਕਿੱਥੇ ਆਪਣਾ ਕੀ ਨਿਕਲਿਆ ਕਿਹੜੀ ਆਪਣਾ ਜੋਬ ਨਿਕਲੀ ਆ ਇੱਦਾਂ ਮੈਂ ਸਾਰੇ ਅਖਬਾਰ ਜਿਵੇਂ ਅਜੀਤ ਜਗਬਾਣੀ ਪੰਜਾਬੀ ਜਾਗਰਣ ਸਪੋਕਸਮੈਨ ਹੈ ਡੇਲੀ ਪੜ੍ਹਦਾ ਹਾਂ ਘੱਟ ਤੋਂ ਘੱਟ ਮੈਂ ਘੰਟਾ ਡੇਢ ਘੰਟਾ ਇਹਨਾਂ ਪੇਪਰਾਂ 'ਤੇ ਲਾਉਂਦਾ ਤਾਂ ਜੋ ਆਪਾਂ ਨੂੰ ਦੁਨੀਆ ਬਾਰੇ ਪਤਾ ਲੱਗ ਸਕੇ ਪੇਪਰਾਂ ਵਿੱਚ ਕੀ ਕਿੱਥੇ ਕੀ ਕੁਛ ਹੋ ਰਿਹਾ ਅਤੇ ਪੋਲੀਟਿਕ ਕਿੱਥੇ ਕਿਹੜਾ ਆਪਾਂ ਨੂੰ ਫਾਇਦੇ ਦੇ ਰਿਹਾ ਅਤੇ ਕਿਹੜਾ ਆਪਾਂ ਨੂੰ ਨੁਕਸਾਨ ਕਰ ਰਿਹਾ ਅਤੇ ਕਿਹੜਾ ਕੋਈ ਕਾਨੂੰਨ ਬਣ ਰਿਹਾ ਅਕਬਾ ਕਾਨੂੰਨ ਸਰਕਾਰ ਕਾਨੂੰਨ ਬਣਾ ਰਹੀ ਹੈ ਜੋ ਕਿ ਕਿਹੜਾ ਆਪਣੇ ਹੱਕ ਵਿੱਚ ਕਾਨੂੰਨ ਬਣਾਉਂਦਾ ਹੈ ਅਤੇ ਕਿਹੜਾ ਆਪਣੇ ਓਪੋਜਿਟ ਬਣਾ ਰਿਹਾ ਤਾਂ ਜੋ ਆਪਾਂ ਨੂੰ ਦਬਲਿਆ ਕੁਚਲਿਆ ਜਾ ਸਕੇ ਇਸ ਤਰ੍ਹਾਂ ਮੈਂ ਸਾਰੇ ਅਖਬਾਰ ਪੜ੍ਹਦਾ ਹਾਂ ਤਾਂ ਜੋ ਸਾਰਿਆਂ ਬਾਰੇ ਪਤਾ ਲੱਗ ਸਕੇ ਜਾਂ ਦੁਨੀਆ ਬਾਰੇ ਪਤਾ ਲੱਗੇ ਕਿੱਥੇ ਕੀ ਹੋ ਰਿਹਾ ਖੇਡਾਂ ਬਾਰੇ ਪਤਾ ਲੱਗੇ ਕਿ ਕਿਹੜਾ ਖਿਡਾਰੀ ਆਪਣਾ ਬਹੁਤ ਵਧੀਆ ਅਤੇ ਕਿਹੜਾ ਕਿੱਥੇ ਕੀ ਕਰ ਰਿਹਾ